ਚੌਦ੍ਹਾਂ ਸੈਪਟੰਬਰ ਦੋ ਹਜ਼ਾਰ ਚਾਰ ਛੇ ਅਗਸਤ ਉੱਨੀ ਸੌ ਪਚਾਨਵੇਂ ਤਿੰਨ ਫਰਵਰੀ ਉੱਨੀ ਸੌ ਨੱਬੇ ਚਾਰ ਅਗ ਦਸੰਬਰ ਦੋ ਹਜ਼ਾਰ ਛੇ

ਦੋ ਦੋ ਸੈਪਟੰਬਰ ਦੋ ਹਜ਼ਾਰ ਤਿੰਨ